ਡਾਂਸ ਜੋ ਕਿ ਮੇਰੀ ਛੋਟੇ ਹੁੰਦੇ ਤੋਂ ਹੀ ਹੋਬੀ ਰਹੀ ਹੈ ਜਿਹਦੇ ਵਿੱਚ ਮੈਂ ਬਹੁਤ ਹੀ ਮੈਨੂੰ ਖੁਸ਼ੀ ਮਿਲਦੀ ਸੀਗੀ ਜਦੋਂ ਵੀ ਫ੍ਰੀ ਟਾਈਮ ਹੋਣਾ ਜਾਂ ਫਿਰ ਹਰ ਟਾਈਮ ਮੈਂ ਕੋਈ ਵੀ ਕੰਮ ਕਰਨਾ ਜਾਂ ਫਿਰ ਹੋਰ ਕੁਛ ਵੀ ਕਰਨਾ ਮੈਂ ਹਰ ਵੇਲੇ ਨੱਚਦੀ ਟੱਪਦੀ ਕੋਈ ਵੀ ਕੰਮ ਖੁਸ਼ੀ ਖੁਸ਼ੀ ਕਰ ਲੈਂਦੀ ਸੀ ਅਤੇ ਜਦੋਂ ਫਿਰ ਮੈਂ ਥੋੜ੍ਹੀ ਜਿਹੀ ਵੱਡੀ ਹੋਈ ਤਾਂ ਮੈਂ ਆਪਣੀਆਂ ਕਲਾਸ ਡਾਂਸ ਕਲਾਸਿਸ ਵੀ ਜੁਆਇਨ ਕੀਤੀਆਂ ਅਤੇ ਫਿਰ ਐਵੇਂ ਦੇਖਦੇ ਦੇਖਦੇ ਅਤੇ ਇੱਕ ਦਿਨ ਮੈਨੂੰ ਮੇਰੇ ਟੀਚਰ ਨੇ ਮੈਨੂੰ ਕਿਹਾ ਕਿ ਹਾਂ ਤੁਸੀਂ ਸਾਡੇ ਕੋ ਸਕੂਲ 'ਚ ਫੰਕਸ਼ਨ ਸੀ ਜਿਹਦੇ ਵਿੱਚ ਮੈਨੂੰ ਟੀਚਰ ਨੇ ਕਿਹਾ ਕਿ ਤੁਸੀਂ ਪਾਰਟੀਸਪੇਟ ਕਰੋ ਇੱਕ ਟਾਈਮ 'ਤੇ ਮੈਨੂੰ ਥੋੜ੍ਹਾ ਨਵ ਨਰਵਸ ਫੀਲ ਕੀਤਾ ਮੈਂ ਅਤੇ ਬਾਅਦ ਵਿੱਚ ਮੈਂ ਆਪਣੇ ਘਰ ਆ ਕੇ ਗੱਲ ਕੀਤੀ ਮੰਮਾ ਨਾਲ ਮੰਮਾ ਨੂੰ ਪੁੱਛਿਆ ਕਿ ਹਾਂ ਐਵੇ ਐਵੇਂ ਮੈਮ ਨੇ ਕਿਹਾ ਕਿ ਮੈਂ ਡਾਂਸ ਵਿੱਚ ਪਾਰਟੀਸਪੇਟ ਕਰਨਾ ਹੈ ਅਤੇ ਮੰਮਾ ਮੇਰਿਆਂ ਨੇ ਵੀ ਮੇਰਾ ਮੈਨੂੰ ਕਿਹਾ ਕਿ ਹਾਂ ਵੀ ਤੁਸੀਂ ਕਰ ਲਉ ਅਤੇ ਇਹਦੇ ਫਿਰ ਮੈਂ ਥੋੜ੍ਹਾ ਜਿਹਾ ਡਰਦੀ ਡਰਦੀ ਦੇ ਨਾਮ ਲਿਖਵਾ ਦਿੱਤਾ ਅਤੇ ਜਦੋਂ ਮੇਰਾ ਫੰਕਸ਼ਨ ਹੋਇਆ ਅਤੇ ਬਾਅਦ ਵਿੱਚ ਮੈਨੂੰ ਜਦੋਂ ਮੈਂ ਡਾਂਸ ਪਰਫੋਰਮੈਂਸ ਆਪਣੀ ਕੀਤੀ ਇੰਨੇ ਲੋਕਾਂ ਦੇ ਸਾਹਮਣੇ ਅਤੇ ਬਾਅਦ ਵਿੱਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੈਨੂੰ ਮੇਰਾ ਡਾਂਸ ਵਧੀਆ ਗਿਆ ਅਤੇ ਜਿਹਦਾ ਕਿ ਮੈਨੂੰ ਹੋਰ ਵੀ ਵਧੀ ਹੋਰ ਜ਼ਿਆਦਾ ਮਤਲਬ ਕਿ ਮੇਰੇ ਅੰਦਰ ਇੱਕ ਭਾਵਨਾ ਪੈਦਾ ਹੋ ਗਈ ਕਿ ਹਾਂ ਮੈਂ ਅੱਗੇ ਅੱਗੇ ਡਾਂਸ ਕਰਨਾ ਹੈ ਅਤੇ ਹੋਰ ਵੀ ਫਿਰ ਮੈਂ ਵਧੀਆ ਡਾਂਸ ਕਲਾਸਿਸ ਲੈਣ ਲਾਪੀ ਜਿੱਦਾਂ ਕਿ ਮੈਂ ਆਪਣੇ ਕੋਲਜ 'ਚ ਜਿਹ 'ਚ ਅੱਗੇ ਐਡਮਿਸ਼ਨ ਲਈ ਅਤੇ ਕੋਲਜ ਵਿੱਚ ਫਸਟ ਸਮੈਸਟਰ ਵਿੱਚ ਹੀ ਸਾਡੇ ਉੱਥੇ ਯੂਥ ਫੈਸਟੀਵਲ ਸੀ ਜਿਹਦੇ ਵਿੱਚ ਮੈਨੂੰ ਟੀਚਰਸ ਨੇ ਕਿਹਾ ਕਿ ਤੁਸੀਂ ਜੇ ਕੋਈ ਹੈ ਤਾਂ ਡਾਂਸ ਕਰ ਲਉ ਤਾਂ ਮੇਰੀ ਫਰੈਂਡ ਨੇ ਮੇਰੇ ਟੀਚਰ ਨੂੰ ਦੱਸ ਦਿੱਤਾ ਜਿਹਦਾ ਕਿ ਮੇਰੇ ਟੀਚਰ ਨੇ ਵੀ ਫਿਰ ਮੇਰਾ ਨਾਮ ਲਿਖ ਦਿੱਤਾ ਫਿਰ ਮੈਨੂੰ ਇੱਕ ਤਾਂ ਹੋ ਰਿਹਾ ਸੀ ਕਿ ਮੈਂ ਕਾਫੀ ਟਾਈਮ ਮਗਰੋਂ ਡਾਂਸ ਕਰਨਾ ਸੀਗਾ ਜਿਹਦੇ ਕਰਕੇ ਮੈਂ ਥੋੜ੍ਹਾ ਨਰਵਸ ਹੋ ਰਹੀ ਸੀਗੀ ਫਿਰ ਮੈਂ ਥੋੜ੍ਹੀ ਪ੍ਰੈਕਟਿਸ ਕੀਤੀ ਜਿਹਦੇ ਕਰਕੇ ਫਿਰ ਮੈਂ ਆਪਣੇ ਯੂਥ ਫੈਸਟੀਵਲ ਵਿੱਚ ਪਾਰਟੀਸਪੇਟ ਕੀਤਾ ਅਤੇ ਸਾਡਾ ਫਸਟ ਪ੍ਰਾਈਜ਼ ਆਇਆ ਸੀ ਫਿਰ ਅੱਗੇ ਯੂਥ ਫੈਸਟੀਵਲ ਤੋਂ ਇੰਟਰ ਜੋਨਲ ਵਿੱਚ ਵੀ ਗਈ ਜਿਹਦੇ ਵਿੱਚ ਉਹਦੇ ਵਿੱਚ ਵੀ ਮੇਰਾ ਪ੍ਰਾਈਜ਼ ਆਇਆ ਸੀ ਫਿਰ ਐਵੇਂ ਹੀ ਬਾਅਦ ਵਿੱਚ ਸਾਡੇ ਕੋਲਜ ਵਿੱਚ ਤੀਜ ਦਾ ਫੰਕਸ਼ਨ ਹੋਇਆ ਜਿਹਦੇ ਵਿੱਚ ਉਹਦੇ ਵਿੱਚ ਵੀ ਮੈਂ ਆਪਣਾ ਨਾਮ ਲਿਖਵਾ ਦਿੱਤਾ ਸੀ ਉਹਦੇ ਵਿੱਚ ਵੀ ਮੇਰਾ ਫਸਟ ਪ੍ਰਾਈਜ਼ ਆਇਆ ਸੀ ਜਿੱਦਾਂ ਕਿ ਮੈਨੂੰ ਡਾਂਸ ਨਾਲ ਬਹੁਤ ਜ਼ਿਆਦਾ ਲਗਾਵ ਹੋ ਗਿਆ ਅਤੇ ਇਹ ਮੇਰਾ ਬਹੁਤ ਜ਼ਿਆਦਾ ਵਧੀਆ ਮੀ ਮਤਲਬ ਕਿ ਮੈਨੂੰ ਫੀਲ ਹੁੰਦਾ ਹੈ ਡਾਂਸ ਕਰਕੇ